ਮੇਰੀਆਂ ਪਸੰਦੀਦਾ ਸ਼ੈਲੀਆਂ ਵਿੱਚ ਵਾਰਤਕ ਸਭ ਤੋਂ ਪਸੰਦੀਦਾਰ ਆ ਅਤੇ ਵਾਰਤਕ 'ਚੋਂ ਨਾਵਲ ਨਾਵਲ ਪੜ੍ਹਨੇ ਮੈਨੂੰ ਬਹੁਤ ਵਧੀਆ ਲੱਗਦੇ ਨੇ ਐਂ ਲੱਗਦਾ ਵੀ ਮੈਂ ਆਪ ਉਸ ਚੀਜ਼ 'ਚ ਹੈਗਾ ਪਾਤਰ ਉਸ ਨਾਵਲ ਦਾ ਕਿਵੇਂ ਕੋਈ ਦੁੱਖ ਦਾ ਸਾਹਮਣਾ ਕਰਦਾ ਕੀ ਕੀ ਚੀਜ਼ਾਂ ਹੁੰਦੀਆਂ ਨੇ ਚੰਗੀਆਂ ਬੁਰੀਆਂ ਐਂ ਲੱਗਦਾ ਅਸਲੀਅਤ ਬੀਤ ਰਹੀ ਹੋਵੇ ਹੁਣ ਮੈਂ ਮੌਜੂਦਾ ਸਮੇਂ ਚ ਕੁਛ ਸਮੇਂ ਪਹਿਲਾਂ ਹੀ ਦਲੀਪ ਕੌਰ ਟਿਵਾਣਾ ਜੀ ਦਾ ਏਹੋ ਹਮਾਰਾ ਜੀਵਣਾ ਨਾਵਲ ਪੜ੍ਹ ਕੇ ਹਟਿਆਂ ਅਤੇ ਉਸ 'ਚ ਮੈਨੂੰ ਐਂ ਲੱਗਦਾ ਸੀ ਵੀ ਸ਼ਾਇਦ ਮੈਂ ਵੀ ਉਸ ਦਾ ਪਾਤਰ ਹੋਵਾਂ ਦਿਲ ਕਰਦਾ ਸੀ ਇਹ ਖਤਮ ਹੀ ਨਾ ਹੋਵੇ ਅੱਗੇ ਅੱਗੇ ਕਹਾਣੀ ਜੁੜੀ ਜਾਵੇ ਜੁੜੀ ਜਾਵੇ ਸੱਚਾਈ ਲੱਗਦੀ ਸੀ ਜ਼ਿੰਦਗੀ ਦੀ ਕਿਉਂਕਿ ਚੀਜ਼ਾਂ ਹੋਈਆਂ ਵੀ ਪਈਆਂ ਨੇ ਪਹਿਲਾਂ ਸੱਚ ਨੇ ਇਹ ਅਸੀਂ ਆਪ ਦੇਖੀਆਂ ਸੁਣੀਆਂ ਵੀ ਨੇ ਇਹ ਚੀਜ਼ਾਂ ਵੀ ਇਹ ਚੀਜ਼ਾਂ ਅਸਲੀਅਤ 'ਚ ਵੀ ਹੁੰਦੀਆਂ ਨੇ ਓਹ 'ਚ ਸਟੋਰੀ ਹਰ ਚੀਜ਼ ਸੀਗੀ ਓਹ 'ਚ ਦੁਖ ਵੀ ਸੁਖ ਵੀ ਹੈ ਨਾ ਹਾਸੀ ਖੁਸ਼ੀ ਹਰ ਚੀਜ਼ ਪਾ ਰੱਖੀ ਸੀ ਅਤੇ ਇੱਕ ਵਾਰ ਤਾਂ ਐਂ ਹੁੰਦਾ ਸੀ ਵੀ ਆਪਣਾ ਘਰ ਦਾ ਕੰਮ ਛੱਡ ਦਈਏ ਪਰ ਇਹਨੂੰ ਪੂਰਾ ਕਰੀਏ ਪੜ੍ਹੀਏ ਇੰਨਾਂ ਰੁਝਾਨ ਹੈ ਇਸ ਚੀਜ਼ ਵੱਲ ਮੇਰਾ